ਮੈਂ ਐਮਜੋਨ ਦੀ ਸੇਲ ਵਿੱਚੋਂ ਇੱਕ ਹੈਡਫੋਨ ਮੰਗਵਾਏ ਉਹ ਹੈਡਫੋਨਸ ਬੋਟ ਦੇ ਬੇਸ ਹੈਡ ਨੌ ਸੌ ਹੈਡਫੋਨ ਸਨ ਉਸ ਦਾ ਡਰਾਈਵ ਸਾਈਜ਼ ਚਾਲ਼ੀ ਐਮ ਐਮ ਅਤੇ ਡਰਾ ਜੈਕ ਡਰਾਈਵ ਤਿੰਨ ਪੁਆਇੰਟ ਪੰਜ ਐਮ ਐਮ ਸੀ ਉਹ ਹੈਡਫੋਨਸ ਸੱਤ ਦਿਨ ਬਾਅਦ ਮੇਰੇ ਘਰ ਡਿਲੀਵਰ ਹੋਏ ਮੈਂ ਜਦੋਂ ਉਹ ਹੈਡਫੋਨਸ ਵਰਤੇ ਤਾਂ ਮੈਨੂੰ ਪਤਾ ਲੱਗਾ ਕਿ ਉਹ ਹੈਡਫੋਨਸ ਖਰਾਬ ਸਨ ਉਹਨਾਂ ਹੈਡਫੋਨਸ ਵਿੱਚੋਂ ਆਵਾਜ਼ ਸਹੀ ਤਰੀਕੇ ਨਾਲ ਨਹੀਂ ਸੀ ਆ ਰਹੀ ਉਹ ਹੈਡਫੋਨਸ ਦੀ ਇੱਕ ਸਾਈਡ ਤਾਂ ਖਰਾਬ ਸੀ ਅਤੇ ਦੂਜੀ ਸਾਈਡ ਤੋਂ ਆਵਾਜ਼ ਫੱਟ ਫੱਟ ਕੇ ਅਤੇ ਰੁਕ ਰੁਕ ਕੇ ਆ ਰਹੀ ਸੀ ਮੈਂ ਉਹਨਾਂ ਨੂੰ ਰਿਪਲੇਸ ਕਰਵਾਇਆ ਸੱਤ ਦਿਨ ਬਾਅਦ ਦੂਜੇ ਹੈਡਫੋਨਸ ਮੇਰੇ ਘਰ ਆਏ ਤਾਂ ਮੈਂ ਵੇਖਿਆ ਕਿ ਉਸਦੀ ਪੈਕਿੰਗ ਫਟੀ ਹੋਈ ਸੀ ਮੈਂ ਉਹ ਉਹ ਵਰਤੇ ਤਾਂ ਮੈਨੂੰ ਪਤਾ ਲੱਗਾ ਕਿ ਉਹ ਵੀ ਖਰਾਬ ਹਨ ਉਸ ਦੀ ਤਾਰ ਖਰਾਬ ਸੀ ਉਸ ਦੀ ਆਵਾਜ਼ ਫੱਟ ਫੱਟ ਕੇ ਆ ਰਹੀ ਸੀ ਮੇਰਾ ਉਸ ਨਾਲ ਅਨੁਭਵ ਬਹੁਤ ਮਾੜਾ ਰਿਹਾ ਮੈਂ ਉਹਨਾਂ ਨੂੰ ਰਿਫੰਡ ਕਰਵਾ ਦਿੱਤਾ ਮੇਰੇ ਪੈਸੇ ਦੋ ਦਿਨ ਬਾਅਦ ਮੇਰੇ ਖਾਤੇ ਵਿੱਚ ਆਏ ਮੈਂ ਉਹਨਾਂ ਤੋਂ ਬਹੁਤ ਨਿਰਾਸ਼ ਹੋਇਆ